ਪੰਜਾਬ ਵਿੱਚ ਬਹੁਤ ਸਾਰੀਆਂ ਗਤੀਵਿਧੀਆਂ ਸਾਰੇ ਸਾਲ ਦੇ ਵਿੱਚ ਹੁੰਦੀਆਂ ਹਨ ਇਤਿਹਾਸਿਕ ਗਤੀਵਿਧੀਆਂ ਵੀ ਬਹੁਤ ਸਾਰੀਆਂ ਜਿਸ ਤਰ੍ਹਾਂ ਕਿ ਤੇਰਾਂ ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਸ੍ਰੀ ਆਨੰਦਪੁਰ ਸਾਹਿਬ ਵਿੱਚ ਵਿਸਾਖੀ ਦਾ ਮੇਲਾ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਜਿੱਥੇ ਕਿ ਨਿਹੰਗ ਸਿੰਘ ਆਪਣੀ ਕਲਾ ਦੇ ਬਹੁਤ ਜੋਰ ਵਿਖਾਉਂਦੇ ਹਨ ਅਤੇ ਇਸ ਤਰ੍ਹਾਂ ਹੀ ਕਿਲ੍ਹਾ ਰਾਏਪੁਰ ਦੇ ਵਿੱਚ ਖੇਡ ਮੇਲਾ ਬਹੁਤ ਵੱਡੇ ਪੰਜਾਬ ਲੈਵਲ 'ਤੇ ਮਨਾਇਆ ਜਾਂਦਾ ਹੈ ਜਿਸ ਵਿੱਚ ਦੂਰੋਂ ਦੂਰੋਂ ਖਿਡਾਰੀ ਹਿੱਸਾ ਲੈਂਦੇ ਹਨ ਜਿਨ੍ਹਾਂ ਵਿੱਚ ਜਿਵੇਂ ਕਿ ਪੁਰਾਣੀਆਂ ਪੇਂਡੂ ਖੇਡਾਂ ਘੋੜ ਦੌੜਾਂ ਬਲਦਾਂ ਦੀਆਂ ਦੌੜਾਂ ਟਰੈਕਟਰਾਂ ਦੀਆਂ ਦੌੜਾਂ ਅੱਜ ਕੱਲ੍ਹ ਦੇ ਨਵੇਂ ਇਹਦੇ ਵਿੱਚ ਐਡ ਕੀਤੀ ਗਈ ਹੈ ਹੋਰ ਵੀ ਬਹੁਤ ਸਾਰੀਆਂ ਖੇਡਾਂ ਦਾ ਆਯੋਜਨ ਕੀਤਾ ਜਾਂਦਾ ਹੈ ਔਰ ਇਸ ਤਰ੍ਹਾਂ ਹੀ ਹਿਸਟੋਰੀਕਲ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਵਾਹਗਾ ਬਾਰਡਰ ਨੂੰ ਸ ਜਨਤਾ ਜੋ ਹੈ ਬਹੁਤ ਦੂਰ ਦੂਰ ਤੋਂ ਦੇਖਣ ਆਉਂਦੀ ਹੈ ਇੱਥੇ ਪਾਕਿਸਤਾਨ ਔਰ ਹਿੰਦੁਸਤਾਨ ਦੀ ਪਰੇਡ ਜਿਹੜੀ ਹੈ ਫੌਜੀਆਂ ਦੀ ਉੱਥੇ ਹੁੰਦੀ ਹੈ ਔਰ ਉਹਦਾ ਆਯੋਜਨ ਬੜੇ ਹੀ ਵੱਡੇ ਪੱਧਰ 'ਤੇ ਕੀਤਾ ਜਾਂਦਾ ਹੈ ਉਸ ਨੂੰ ਵੀ ਜ ਦੁਨੀਆ ਬਹੁਤ ਦੂਰ ਦੂਰ ਤੋਂ ਹਿੰਦੁਸਤਾਨ ਤੋਂ ਦੇਖਣ ਲਈ ਆਉਂਦੀ ਹੈ ਇਸ ਤਰ੍ਹਾਂ ਹੀ ਅੰਮ੍ਰਿਤਸਰ ਦੇ ਵਿੱਚ ਹਰਿਮੰਦਰ ਸਾਹਿਬ ਨੂੰ ਦਰਸ਼ਨ ਕਰਨ ਔਰ ਦੁਰਗਿਆਣਾ ਮੰਦਿਰ ਤੀਰਥ 'ਤੇ ਦਰਸ਼ਨ ਕਰਨ ਰਾਮ ਤੀਰਥ ਜੋ ਕਿ ਰਾਮ ਚੰਦਰ ਜੀ ਮਹਾਰਾਜ ਨਾਲ ਸੰਬੰਧਿਤ ਹੈ ਲਵ ਕੁਸ਼ ਆਸ਼ਰਮ ਵਾਲਮੀਕ ਆਸ਼ਰਮ ਵੀ ਜਿਸ ਨੂੰ ਕਿਹਾ ਜਾਂਦਾ ਹੈ ਉੱਥੇ ਵੀ ਬਹੁਤ ਦੂਰ ਤੋਂ ਦੁਨੀਆਂ ਦੇਖਣ ਆਉਂਦੀ ਹੈ ਔਰ ਇਸ ਤਰ੍ਹਾਂ ਹੀ ਪੰਜਾਬ ਵਿੱਚ ਬਹੁਤ ਸਾਰੇ ਸ਼ਹੀਦੀ ਜੋੜ ਮੇਲਾ ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਮਨਾਇਆ ਜਾਂਦਾ ਹੈ ਜੋ ਕਿ ਛੋਟੇ ਸਾਹਿਬਜ਼ਾਦਿਆਂ ਨਾਲ ਸ਼ਹਾਦਤ ਨਾਲ ਰਿਲੇਟਡ ਹੈ ਉੱਥੇ ਵੀ ਬਹੁਤ ਵੱਡਾ ਇਕੱਠ ਹੁੰਦਾ ਹੈ ਜਿੱਥੇ ਕਿ ਦੁਨੀਆ ਬਹੁਤ ਦੂਰੋਂ ਦੂਰੋਂ ਉਸ ਜੋੜ ਮੇਲੇ 'ਚ ਹਿਸਾ ਲੈਣ ਆਉਂਦੀ ਹੈ ਅਤੇ ਇਸ ਤਰ੍ਹਾਂ ਪੰਜਾਬ ਵਿੱਚ ਹੋਰ ਵੀ ਬਹੁਤ ਸਾਰੀਆਂ ਗਤੀਵਿਧੀਆਂ ਸਾਰਾ ਸਾਲ ਹੁੰਦੀਆਂ ਹੀ ਰਹਿੰਦਿਆ ਹਨ